ਹਾਂਜੀ ਪਿਛਲੇ ਹੀ ਮਹੀਨੇ ਮੇਰਾ ਜਨਮਦਿਨ ਸੀ ਅਤੇ ਮੈੈਂ ਅਤੇ ਮੇਰੇ ਫਰੈਂਡਸ ਜਨਮਦਿਨ ਮਨਾਉਣ ਲਈ ਇਕੱਠੇ ਹੋਏ ਸੀ ਅਤੇ ਅਸੀਂ ਖਾਣਾ ਔਡਰ ਕਰ ਦਿੱਤਾ ਸੀ ਪਰ ਸਾਡੇ ਵਿੱਚੋਂ ਕਿਸੇ ਨੂੰ ਵੀ ਉਸ ਰੈਸਟੋਰੈਂਟ ਦਾ ਪਹਿਲਾਂ ਕੋਈ ਅਨੁਭਵ ਨਹੀਂ ਸੀ ਸੋ ਇਸ ਲਈ ਅਸੀਂ ਉੱਥੋਂ ਦੇ ਕੁਛ ਲੋਕਾਂ ਨੂੰ ਪੁੱਛਿਆ ਕਿ ਖਾਣਾ ਕਿੰਨੇ ਟਾਈਮ ਵਿੱਚ ਡਿਲੀਵਰ ਹੋ ਜਾਂਦਾ ਹੈ ਵੇਟਰ ਦੇ ਅਨੁਸਾਰ ਖਾਣਾ ਬਣਾਉਣ ਨੂੰ ਲਗਭਗ ਪੰਨਤਾਲੀ ਮਿੰਟ ਲੱਗਣੇ ਸਨ ਪਰ ਸਾਡੇ ਵਿੱਚੋਂ ਕਿਸੇ ਨੂੰ ਵੀ ਪਹਿਲਾਂ ਕੋਈ ਐਕਸਪੀਰੀਅੰਸ ਨਾ ਹੋਣ ਕਰਕੇ ਸਾਡੇ ਕੋਲ ਕੋਈ ਵੀ ਐਪ ਜਾਂ ਕੋਈ ਵੀ ਵੈਬਸਾਈਟ ਨ ਨਹੀਂ ਸੀ ਸੋ ਅਸੀਂ ਕਿਸੇ ਦੀ ਹੈਲਪ ਲੈ ਕੇ ਰੈਸਟੋਰੈਂਟ ਦੇ ਐਪ ਨੂੰ ਪਹਿਲਾਂ ਤਾਂ ਇੰਟਰਨੈਟ ਉਤੋਂ ਡਾਉਨਲੋਡ ਕੀਤਾ ਅਤੇ ਫਿਰ ਅਸੀਂ ਆਪਣਾ ਉੱਥੇ ਪਹੁੰਚਣ ਦਾ ਸਮਾਂ ਪਾ ਕੇ ਅਤੇ ਔਡਰ ਦਾ ਸਮਾਂ ਪਾ ਕੇ ਐਪ ਉਤੋਂ ਡਿਲੀਵਰੀ ਔਡਰ ਡਿਲੀਵਰੀ ਹੋਣ ਦਾ ਸਮਾਂ ਚੈੱਕ ਕੀਤਾ ਜਿਸ ਤੋਂ ਕਿ ਮੈਨੂੰ ਪਤਾ ਲੱਗਿਆ ਕਿ ਖਾਣਾ ਪੱਚੀ ਮਿੰਟ ਦੇ ਵਿੱਚ ਡਿਲੀਵਰ ਹੋ ਜਾਵੇਗਾ